ਹਾਂਜੀ ਮੈਨੂੰ ਇੱਕ ਚੀਜ਼ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਪਿਆ ਹੈ ਜਦੋਂ ਮੈਂ ਆਪਣੇ ਸਟੈਨੋਗ੍ਰਾਫੀ ਦੀ ਇੰਟਰਵਿਊ ਦਿੱਤੀ ਸੀ ਤਾਂ ਕਚਹਿਰੀਆਂ ਦੇ ਵਿੱਚ ਮੈਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਪਿਆ ਜੋ ਕਿ ਇੱਕ ਬਹੁਤ ਹੀ ਜ਼ਰੂਰੀ ਅਤੇ ਵਿਸ਼ਵਾਸਯੋਗ ਸੀ